ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਾਲੇ ਮੈਂ ਕੁਛ ਦਿਨਾਂ ਪਹਿਲਾਂ ਇੱਕ ਹੈਡਫੋਨ ਬਾਏ ਕੀਤਾ ਹੈ ਬੌਟ ਕੰਪਨੀ ਦਾ ਫਲਿੱਪਕਾਟ ਤੋਂ ਜੋ ਕਿ ਮੇਰਾ ਪਹਿਲਾ ਪ੍ਰੋਡਕਟ ਹੈ ਅਤੇ ਮੈਨੂੰ ਬਹੁਤ ਹੀ ਸੰਤੁਸ਼ਟੀ ਹੈ ਇਸ ਪ੍ਰੋਡਕਟ ਤੋਂ ਅਤੇ ਇਸ ਦੀ ਵਜ੍ਹਾ ਮੇਰੀ ਪੜ੍ਹਾਈ ਹੈ ਕਿਉਂਕਿ ਮੈਨੂੰ ਯੂਟੀਊਬ 'ਤੇ ਪੜ੍ਹਨ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਫਲਿੱਪਕਾਟ 'ਤੇ ਜਾ ਕੇ ਪਹਿਲਾ ਕੁਛ ਰੀਵਿਊ ਚੈੱਕ ਕੀਤੇ ਜੋ ਕਿ ਮੈਨੂੰ ਬਹੁਤ ਵਧੀਆ ਲੱਗੇ ਕਿਉਂਕਿ ਬੌਟ ਕੰਪਨੀ ਬਹੁਤ ਵਧੀਆ ਕੰਪਨੀ ਹੈ ਇਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਤੋਂ ਸਲਾਹ ਲਿੱਤੀ ਜਿਹਨਾਂ ਨੇ ਮੈਨੂੰ ਬੋਲਿਆ ਕਿ ਬੋਟ ਕੰਪਨੀ ਦੇ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਮੇਰੇ ਘਰ ਦੀਆਂ ਆਵਾਜ਼ਾਂ ਵਿੱਚ ਮੈਨੂੰ ਬਹੁਤ ਹੀ ਮਦਦ ਕਰਾਂਗੇ ਮੇਰੀ ਪੜ੍ਹਾਈ ਵਿੱਚ ਅਤੇ ਜਿਹੜਾ ਡਿਲੀਵਰੀ ਬੋਆਏ ਸੀ ਉਹ ਬਹੁਤ ਹੀ ਵਧੀਆ ਸੀ ਉਹਨੂੰ ਮੈਂ ਟਿੱਪ ਦੇਣੀ ਚਾਹੀ ਪਰ ਉਹਨੇ ਮਨ੍ਹਾਂ ਕਰ ਦਿੱਤਾ ਅਤੇ ਮੇਰੇ ਨਾਲ ਬਹੁਤ ਹੀ ਵਧੀਆ ਤਰ੍ਹਾਂ ਦਾ ਵਿਵਹਾਰ ਕੀਤਾ ਅਤੇ ਮੈਂ ਅੱਗੇ ਤੋਂ ਇਹੀ ਚਾਹਾਂਗਾ ਕਿ ਜਿਹੜੇ ਵੀ ਪ੍ਰੋਡਕਟ ਮੈਂ ਮੰਗਵਾਵਾਂ ਫਲਿੱਪਕਾਟ ਤੋਂ ਹੀ ਮੰਗਵਾਵਾਂ ਅਤੇ ਬਹੁਤ ਹੀ ਵਧੀਆ ਤਰ੍ਹਾਂ ਦੀ ਡਿਲੀਵਰੀ ਹੁੰਦੀ ਆ ਧੰਨਵਾਦ